ਮੈਂ ਭੱਲਾ ਬੇਟ ਦੀ ਵਿਖੇ ਰਹਿਣ ਵਾਲੀ ਹਾਂ ਮੇਰੇ ਨੇੜਲੇ ਪਿੰਡ ਕਾਠਗੜ੍ਹ ਬਲਾਚੋਰ ਤਾਜੋਵਾਲ ਟੌਂਸਾ ਇਹ ਪਿੰਡ ਬਹੁਤ ਹੀ ਵਧੀਆ ਹਨ ਮੈਂ ਇੱਥੇ ਹਫ਼ਤੇ 'ਚ ਦੋ ਤਿੰਨ ਵਾਰ ਤਾਂ ਜਾਂਦੀ ਹੀ ਹਾਂ ਇੱਥਾਂ ਦੇ ਪਹਿਲਾਂ ਤਾਂ ਰੋਡ ਬਹੁਤ ਹੀ ਟੁੱਟੇ ਫੁੱਟੇ ਹੁੰਦੇ ਸੀ ਹੁਣ ਤਾਂ ਸਰਕਾਰ ਨੇ ਮਿਹਨਤ ਨਾਲ਼ ਬਹੁਤ ਹੀ ਪੱਕੇ ਰੋਡ ਕਰ ਦਿੱਤੇ ਹਨ ਇੱਥੇ ਦੇ ਸਕੂਲ ਵੀ ਬਹੁਤ ਹੀ ਵਧੀਆ ਬਣਾ ਦਿੱਤੇ ਹਨ ਮੈਂ ਤਾਂ ਇੱਥੇ ਹਫ਼ਤੇ 'ਚ ਦੋ ਤਿੰਨ ਵਾਰ ਤਾਂ ਜਾਂਦੀ ਹੀ ਹਾਂ ਮੇਰੇ ਇੱਥੇ ਨੇੜਲੇ ਰਿਸ਼ਤੇਦਾਰ ਵੀ ਰਹਿੰਦੇ ਹਨ